ਕਾਰੋਬਾਰ ਸ਼ੁਰੂ ਕਰਦੇ ਸਮੇਂ ਪੇਂਡੂ ਲੋਕਾਂ ਨੂੰ ਇੱਕ ਤਾਂ ਸਭ ਤੋਂ ਪਹਿਲਾਂ ਹੈ ਟੈਕਨੋਲੋਜੀ ਜੋ ਪੇਂਡੂ ਲੋਕ ਨੇ ਉਹਨਾਂ ਕੋਲ ਕਿਉਂਕਿ ਉਹ ਟੈਕਨੋਲੋਜੀ ਤੋਂ ਅਵੇਅਰ ਨਹੀਂ ਹਨ ਤਾਂ ਉਹਨਾਂ ਨੂੰ ਨਵੀਂ ਟੈਕਨੋਲੋਜੀ ਮਤਲਬ ਕਿ ਨਵੀਂ ਤਕਨੀਕ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਦੂਸਰਾ ਉਹਨਾਂ ਨੂੰ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਾਰੋਬਾਰ ਵਿੱਚ ਉਹ ਹੈ ਇਨਵੈਸਟਮੈਂਟ ਮਤਲਬ ਕਿ ਉਹਨਾਂ ਕੋਲ ਐਨੇ ਰਿਸੋਰਸਿਜ ਨਹੀਂ ਹੁੰਦੇ ਕਿ ਉਹ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰ ਸਕਣ ਇੰਨਾ ਪੈਸਾ ਨਹੀਂ ਹੁੰਦਾ ਸੋ ਜੋ ਭਾਰਤ ਸਰਕਾਰ ਹੈ ਉਹਨੂੰ ਚਾਹੀਦਾ ਹੈ ਕਿ ਪੇਂਡੂ ਲੋਕਾਂ ਨੂੰ ਪਹਿਲਾਂ ਤਾਂ ਨਵੀਂ ਟੈਕਨੋਲੋਜੀ ਤੋਂ ਅਵੇਅਰ ਕਰਵਾਉਣ ਇਸ ਲਈ ਸਮੇਂ ਸਮੇਂ 'ਤੇ ਸੈਮੀਨਾਰਸ ਵਰਕਸ਼ੋਪਸ ਵਗੈਰਾ ਲਗਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਉਹਨਾਂ ਨੂੰ ਨਵੇਂ ਨਵੇਂ ਕੰਮਾਂ ਬਾਰੇ ਜਾਣਕਾਰੀ ਦੇ ਸਕਣ ਦੂਸਰਾ ਹੈ ਪੈਸੇ ਦੀ ਸਮੱਸਿਆ ਤਾਂ ਇਸ ਲਈ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਲਈ ਲੋਨ ਮਤਲਬ ਕਿ ਕਰਜ਼ਾ ਲੈਣ ਦੀ ਜਿਹੜੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਸਭ ਤੋਂ ਪਹਿਲਾਂ ਉਹਨੂੰ ਕੀ ਕਰਨ ਸੋਲਵ ਕਰਨ ਉਹਨਾਂ ਲਈ ਲੋਨ ਦੇ ਲਈ ਬੈਂਕ ਵਿੱਚ ਸੁਵਿਧਾਵਾਂ ਦਿੱਤੀਆਂ ਜਾਣ ਤਾਂ ਕਿ ਉਹ ਬੜੀ ਆਸਾਨੀ ਨਾਲ ਕਾਰੋਬਾਰ ਸ਼ੁਰੂ ਕਰਨ ਲਈ ਲੋਨ ਲੈ ਸਕਣ ਅਤੇ ਉਹਨਾਂ ਲਈ ਬੜੀ ਈਜ਼ੀ ਇੰਸਟਾਲਮੈਂਟ ਹੋਣੀਆਂ ਚਾਹੀਦੀਆਂ ਹਨ ਜਿਹਦੇ ਨਾਲ ਉਹ ਆਪਣਾ ਕਰਜ਼ਾ ਬੜੀ ਆਸਾਨ ਕਿਸ਼ਤਾਂ ਵਿੱਚ ਚੁਕਾ ਸਕਣ ਅਤੇ ਘੱਟ ਰੇਟ ਆਫ ਇੰਟਰਸਟ 'ਤੇ ਉਹਨਾਂ ਨੂੰ ਇਹ ਲੋਨ ਮਿਲ ਜਾਣਾ ਚਾਹੀਦਾ ਹੈ